ਪੰਜਾਬੀ ਲੋਕ ਆਪਣੀ ਪਛਾਣ ਅਤੇ ਸਬੰਧਤ ਦੀ ਭਾਵਨਾ ਨੂੰ ਪ੍ਰਗਟ ਕਰਨ ਲਈ ਆਪਣੀ ਭਾਸ਼ਾ ਦੀ ਵਰਤੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਰਦੇ ਆ ਸਭ ਤੋਂ ਪਹਿਲਾਂ ਕੀ ਆ ਜਿਹੜੇ ਪੰਜਾਬੀ ਲੋਕ ਆ ਉਹਨਾਂ ਦੀ ਮਾਤ ਭਾਸ਼ਾ ਜਿਹੜੀ ਆ ਉਹ ਪੰਜਾਬੀ ਆ ਉਹ ਜਦੋਂ ਵੀ ਕਿਸੇ ਆਪਣੇ ਸਬੰਧਤ ਨੂੰ ਮਿਲਦੇ ਆ ਤਾਂ ਉਹ ਪੰਜਾਬੀ ਦੇ ਵਿੱਚ ਗੱਲ ਕਰਦੇ ਆ ਆਪਣਾ ਸਾਰਾ ਉਹ ਪੰਜਾਬੀ ਬੋਲ ਕੇ ਦੱਸਦੇ ਆ ਮੈਂ ਕੌਣ ਆ ਕਿੱਥੋਂ ਆਇਆ ਕੀ ਕਰਦਾ ਮੈਂ ਕੀ ਕੀਤਾ ਸਾਰਾ ਕੁਛ ਕੀ ਆ ਉਹ ਪੰਜਾਬੀ ਦੇ ਵਿੱਚ ਦੱਸਦੇ ਆ ਦੂਸਰਾ ਜਿਹੜਾ ਪੰਜਾਬੀਆਂ ਦਾ ਪਹਿਰਾਵਾ ਉਹ ਅਲੱਗ ਕਿਸਮ ਦਾ ਹੈ ਜਿਹੜੀ ਪਛਾਣ ਆ ਗਈ ਪੰਜਾਬੀ ਬੰਦੇ ਦੀ ਇੱਕ ਤਾਂ ਉਹ ਪੰਜਾਬੀ ਬੋਲੀ ਤੋਂ ਹੁੰਦੀ ਹੈ ਦੂਸਰਾ ਉਹਦੀ ਪਹਿਚਾਣ ਕੀ ਹੈ ਸਿਰ ਦੇ ਉੱਤੇ ਉਹ ਟਰਬਨ ਜਿਹਨੂੰ ਆਪਾਂ ਪੱਗੜੀ ਕਹਿੰਦੇ ਹਾਂ ਪੱਗੜੀ ਬੰਨਦੇ ਆ ਉਹ ਅਗਰ ਪੰਜ ਸੌ ਬੰਦੇ ਦੇ ਵਿੱਚ ਪੰਜ ਬੰਦੇ ਵੀ ਆ ਤਾਂ ਉਹਨਾਂ ਦੀ ਪਛਾਣ ਆ ਜਿਹੜੀ ਪੱਗ ਤੋਂ ਕੀਤੀ ਜਾਂਦੀ ਆ ਦੂਰੋਂ ਹੀ ਪਤਾ ਚੱਲ ਜਾਊਗਾ ਵੀ ਇਹ ਪੱਗ ਵਾਲਾ ਜਿਹੜਾ ਬੰਦਾ ਇਹ ਪੰਜਾਬੀ ਲੋਕ ਆ ਇਹ ਉਹ ਉਹਦੀ ਪਛਾਣ ਆ ਗਈ ਜਿਹੜੇ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਨੇ ਜਿਵੇਂ ਕਿ ਪਿੰਡਾਂ ਦੇ ਵਿੱਚ ਉਹਨਾਂ ਦੀ ਪਛਾਣ ਆ ਗਈ ਪੁਰਾਣੇ ਲੋਕ ਆ ਜਿਹੜੇ ਜਿਹੜੇ ਬਜ਼ੁਰਗ ਨੇ ਹੁਣ ਵੀ ਹੈਗੇ ਆ ਉਹ ਕੁੜਤਾ ਚਾਦਰਾ ਤਿੱਲੇ ਵਾਲੀ ਜੁੱਤੀ ਪਾਉਂਦੇ ਆ ਸਿਰ 'ਤੇ ਪੱਗ ਬੰਨ੍ਹਦੇ ਆ ਜਿਹੜਾ ਖੂੰਡਾ ਉਹ ਹੱਥ ਦੇ ਵਿੱਚ ਰੱਖਦੇ ਆ ਮੁੱਛਾਂ ਕੁੰਡੀਆਂ ਰੱਖਦੇ ਨੇ ਦਾੜ੍ਹੀ ਰੱਖਦੇ ਆ ਇਹ ਸਾਰਾ ਕੁਛ ਹੀ ਪੰਜਾਬੀਆਂ ਦੀ ਇੱਕ ਤਰ੍ਹਾਂ ਦੀ ਪਛਾਣ ਆ ਉਹ ਆਪਣੇ ਸਬੰਧਤ ਦੀ ਭਾਵਨਾ ਨੂੰ ਪ੍ਰਗਟ ਕਰਨ ਲਈ ਸਰਲ ਭਾਸ਼ਾ ਬੋਲਦੇ ਆ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਦੇਸੀ ਭਾਸ਼ਾ ਉਹ ਭਾਸ਼ਾ ਦੇ ਨਾਲ ਕੀ ਆ ਉਹ ਇੱਕ ਦੂਜੇ ਦੇ ਨਾਲ ਗੱਲ ਕਰਦੇ ਆ ਉਹਨਾਂ ਨੂੰ ਸਮਝਣ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹ ਸਮਝਦੇ ਆ ਗੱਲਬਾਤ ਕਰਦੇ ਆ ਇੱਕ ਦੂਜੇ ਦੀਆਂ ਭਾਵਨਾ ਨੂੰ ਪ੍ਰਗਟ ਕਰਦੇ ਆ ਇਸ ਤਰੀਕੇ ਦੇ ਨਾਲ ਪੰਜਾਬੀ ਲੋਕਾਂ ਦੀ ਪਛਾਣ ਆ ਗਈ ਦੂਸਰਾ ਜਿਹੜਾ ਪੂਰੇ ਹੀ ਵਰਲਡ ਦੇ ਵਿੱਚ ਪੰਜਾਬੀ ਲੋਕ ਭੰਗੜਾ ਭੰਗੜੇ ਤੋਂ ਕੀ ਆ ਪੰਜਾਬੀ ਲੋਕ ਬਹੁਤ ਮਸ਼ਹੂਰ ਨੇ ਅੱਜ ਕੱਲ੍ਹ ਦੇਖੋ ਤੁਸੀਂ ਜਿਹੜੇ ਪੰਜਾਬੀ ਲੋਕ ਨੇ ਕੋਈ ਵੀ ਐਕਟਰ ਆ ਕਲਾਕਾਰ ਆ ਉਹਨਾਂ ਦੀ ਪਛਾਣ ਅਲੱਗ ਹੀ ਹੈ ਜਿਵੇਂ ਕਲਾਕਾਰਾਂ ਦੇ ਵਿੱਚ ਗੁਰਦਾਸ ਮਾਨ ਆ ਗਿਆ ਅਤੇ ਬਹੁਤ ਹੀ ਮਸ਼ਹੂਰ ਸਿੰਗਰ ਸੀ ਜਿਹੜੇ ਸਿੱਧੂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਜਿਹਨਾਂ ਦੀ ਮੌਤ ਹੋ ਉਹਨਾਂ ਦਾ ਪੂਰੇ ਵਰਲਡ ਦੇ ਵਿੱਚ ਕੀ ਆ ਇੱਕ ਪੰਜਾਬੀ ਹੋਣ ਦੇ ਨਾਂ 'ਤੇ ਪਹਿਰਾਵਾ ਜਿਹੋ ਜੇ ਉਹਨਾਂ ਦੇ ਸੌਗ ਗਾਏ ਉਹਨਾਂ ਨੇ ਉਹ ਤੋਂ ਕੀ ਉਹਨਾਂ ਦੀ ਪਛਾਣ ਅਮਰੀਕਾ ਕਨੇਡਾ ਪਤਾ ਨਹੀਂ ਕਿੱਥੋਂ ਕਿੱਥੋਂ ਉਹਦੇ ਪਿੰਡ ਲੋਕ ਆਉਂਦੇ ਨੇ ਜਿਹੜੇ ਉਹਦੇ ਕੀ ਆ ਜਿੱਥੇ ਸ਼ਹਾਦਤ ਹੋਈ ਆ ਉਹਦੀ ਡੈਥ ਹੋਈ ਆ ਜਾਂ ਉਹਦਾ ਫੋਟੋ ਵਗੈਰਾ ਲੱਗੀ ਆ ਉਹਦਾ ਘਰ ਆ ਉੱਥੇ ਪਹੁੰਚਦੇ ਆ ਇਸ ਤਰੀਕੇ ਦੇ ਨਾਲ ਕੀ ਆ ਪੰਜਾਬੀਆਂ ਦੀ ਪਹਿਚਾਣ ਆ ਗਈ ਜਿਹੜੇ ਕੋਈ ਟਰੱਕ ਡਰਾਈਵਰ ਨੇ ਆਪਣੇ ਬਾਹਰ ਜਾਂਦੇ ਦੇਖੋ ਪੰਜਾਬ ਵਾਲੇ ਉਹਨਾਂ ਦਾ ਦੂਰੋਂ ਹੀ ਪਤਾ ਚੱਲ ਜਾਂਦਾ ਇਹ ਪੰਜਾਬੀ ਹੈ ਇਹ ਜਿਹੜਾ ਟਰੱਕ ਡਰਾਈਵਰ ਆਇਆ ਵੱਡੇ ਵੱਡੇ ਸ਼ਹਿਰਾਂ 'ਚ ਦੇਖ ਲਓ ਜਿਵੇਂ ਕਲਕੱਤੇ ਆ ਅਗਰ ਉੱਥੇ ਪੰਜਾਬੀ ਇੱਕ ਸ ਕਸਬਾ ਜਾਂ ਇਸ ਟੈਪ 'ਤੇ ਰਹਿੰਦੇ ਆ ਤਾਂ ਪਤਾ ਲੱਗ ਜਾਂਦਾ ਇਹ ਸਾਰੇ ਪੰਜਾਬੀ ਲੋਕ ਆ ਉਹਨਾਂ ਦੇ ਪਹਿਰਾਵੇ ਤੋਂ ਰਹਿਣ ਸਹਿਣ ਤੋਂ ਖਾਦ ਖੁਰਾਕ ਤੋਂ ਗੱਲਬਾਤ ਕਰਨ ਤੋਂ ਬਹੁਤ ਬਹੁਤ ਧੰਨਵਾਦ ਜੀ